ਚੋਣਾਂ ਦੌਰਾਨ ਜਿਹੜੀ ਸਭ ਤੋਂ ਵੱਡੀ ਮੁਸ਼ਕਿਲ ਤਾਂ ਇਹ ਆ ਕਿ ਸਰਕਾਰੀ ਜਿਹੜਾ ਕੰਮ ਕਿਸੇ ਬੰਦੇ ਨੇ ਕਰਵਾਉਣਾ ਦਫਤਰਾਂ ਦੇ ਵਿੱਚ ਜਾ ਕੇ ਉਹਦੇ ਵਿੱਚ ਬਹੁਤ ਵੱਡੀ ਰੁਕਾਵਟ ਪੈਦਾ ਹੋ ਗਈ ਚੋਣਾਂ ਦੌਰਾਨ ਕਿਉਂਕਿ ਸਾਰੇ ਜ ਅਧਿਕਾਰੀ ਜਿਹੜੇ ਸਰਕਾਰੀ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਚੋਣਾਂ ਦੇ ਵਿੱਚ ਸੋ ਜੇ ਕਿਸੇ ਆਮ ਆਦਮੀ ਨੇ ਆਮ ਬੰਦੇ ਨੇ ਕੋਈ ਕੰਮ ਆਪਣਾ ਕਰਾਉਣਾ ਆ ਪਰਸਨਲ ਦਫਤਰਾਂ 'ਚ ਜਾ ਕੇ ਉਹਨੂੰ ਬਹੁਤ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਕਿਉਂਕਿ ਉਹਦਾ ਕੰਮ ਛੇਤੀ ਹੁੰਦਾ ਨਹੀਂ ਕਿਉਂਕਿ ਜਿਹੜੇ ਅਫਸਰ ਆ ਉਹਨਾਂ ਦੀਆਂ ਡਿਊਟੀਆਂ ਚੋਣਾਂ ਦੇ ਵਿੱਚ ਲੱਗੀਆਂ ਕੋਈ ਮਿਲਦਾ ਨਹੀਂ ਗਾ ਸੋ ਸਭ ਤੋਂ ਵੱਡੀ ਪਰੇਸ਼ਾਨੀ ਇਹ ਆ ਸੋ ਉਸ ਤੋਂ ਬਾਅਦ ਜਿਹੜੀ ਆ ਸਟੂਡੈਂਟ ਦੇ ਲਈ ਪਰੇਸ਼ਾਨੀ ਆ ਬਹੁਤ ਵੱਡੀ ਕਿਉਂਕਿ ਉਹਨਾਂ ਦੀ ਪੜ੍ਹਾਈ ਜਿਹੜੀ ਆ ਸਹੀ ਢੰਗ ਦੇ ਨਾਲ ਨਹੀਂ ਹੋ ਪਾ ਰਹੀ ਕਿਉਂਕਿ ਜਿਹੜੇ ਉਹਨਾਂ ਨੂੰ ਪੜ੍ਹਾਉਣ ਵਾਲੇ ਟੀਚਰ ਆ ਉਹਨਾਂ ਦੀਆਂ ਵੀ ਲਗਭਗ ਡਿਊਟੀਆਂ ਲੱਗੀਆਂ ਹੋਈਆਂ ਚੋਣਾਂ ਦੇ ਵਿੱਚ ਹਰ ਇੱਕ ਦੀਆਂ ਸੋ ਜਿਹੜੀ ਉਹਨਾਂ ਦੀ ਪੜ੍ਹਾਈ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਪੈ ਰਿਹਾ ਸੋ ਇਹ ਵੀ ਚੋਣਾਂ ਦੌਰਾਨ ਬਹੁਤ ਵੱਡੀ ਇੱਕ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੇ ਸ ਲਗਭਗ ਕੋਈ ਵੀ ਆਪਾਂ ਸਰਕਾਰੀ ਮੁਲਾਜ਼ਮ ਕਹਿ ਲਈਏ ਸਾਰਿਆ ਦੀਆ ਤਕਰੀਬਨ ਚੋਣਾਂ ਦੇ ਵਿੱਚ ਡਿਊਟੀਆਂ ਲੱਗੀਆ ਹੀ ਆ ਸੋ ਜਿਹੜੀ ਆਮ ਪਬਲਿਕ ਆ ਉਹਦੇ ਵਾਸਤੇ ਬਹੁਤ ਵੱਡੀ ਪਰੇਸ਼ਾਨੀ ਆ ਕਿਉਂਕਿ ਉਹਨਾ ਨੇ ਕਿਤੇ ਵੀ ਕੰਮ ਕਰਾਉਣਾ ਆ ਜਾਂ ਕੋਈ ਸਟੂਡੈਂਟ ਆ ਉਹਨੇ ਆਪਣਾ ਪੜ੍ਹਾਈ ਕਰਨੀ ਆ ਉਹਨਾਂ ਨੂੰ ਟੀਚਰ ਨਹੀਂ ਮਿਲ ਪਾ ਰਹੇ ਅਤੇ ਜਿਹੜੇ ਆਮ ਪਬਲਿਕ ਆ ਉਹਨੂੰ ਅਫਸਰ ਨਹੀਂ ਮਿਲ ਪਾ ਰਿਹਾ ਸੋ ਆਪ ਕੰਮ ਕਰਾਊਗਾ ਕਿੱਦਾਂ ਸੋ ਇਹ ਸਭ ਤੋਂ ਵੱਡੀ ਚੋਣਾਂ ਦੌਰਾਨ ਮੇਨ ਜਿਹੜੀਆਂ ਦੋ ਇਹੀ ਮੇਨ ਮੁਸ਼ਕਿਲਾਂ ਆ